ਹਾਂਜੀ ਸਤਿ ਸ਼੍ਰੀ ਅਕਾਲ ਜੀ ਸੌ ਰੁਪਈਆ ਜੀ ਪੰਜ ਸੌ ਜੀ ਇੱਕ ਹਜ਼ਾਰ ਦਸ ਹਜ਼ਾਰ ਦੋ ਲੱਖ ਰੁਪਈਆਂ ਜੀ ਇਹ ਸੀਗੇ ਜੀ ਤੁਹਾਨੂੰ ਬੋਲ ਦਿੱਤੀਆਂ ਸਾਰੀਆਂ ਰਕਮਾਂ ਦੇ ਠੀਕ ਹੈ ਜੀ ਦੋ ਤਿੰਨ ਹੋਗੇ ਸਾਰੇ ਠੀਕ ਹੈ ਓਕੇ ਜੀ